ਹੈਲੋ ਸਤਿ ਸ਼੍ਰੀ ਅਕਾਲ ਬਸ ਵਧੀਆ ਵਧੀਆ ਸਭ ਠੀਕ ਠਾਕ ਕੁਛ ਨਹੀਂ ਫਰੀ ਤੁਸੀਂ ਸੁਣਾਓ ਕਿਵੇਂ ਯਾਦ ਕੀਤਾ ਦੱਸੋ ਹਾਂਜੀ ਅੱਛਾ ਅੱਛਾ ਆਪਣੀ ਲੁਕੈਲਟੀ ਦੇ ਵਿੱਚ ਸਕੂਲ ਜਿਹੜੇ ਹੈਗੇ ਆ ਜਿਸ ਤਰ੍ਹਾਂ ਨੇੜੇ ਸਾਡੇ ਪੈ ਜਾਂਦਾ ਹੈ ਲਿਟਲ ਫਲਾਵਰ ਕਾਨਵੈਂਟ ਸਕੂਲ ਇਹ ਕਲਗੀਧਰ ਹੋ ਗਿਆ ਫਿਰ ਥੋੜ੍ਹਾ ਗੁਰਦਾਸਪੁਰ ਦੇ ਦੂਨ ਆਰਮੀ ਕੈਂਟ ਵੀ ਹੈ ਪਰ ਜਿਹੜੇ ਆਪਣੇ ਬੱਚੇ ਹੈ ਉਹ ਲਿਟਲ ਫਲਾਵਰ 'ਚ ਹੀ ਜਾਂਦੇ ਹੈ ਪੁਰਾਣੇ ਛਾਲੇ ਦੀ ਅੱਛਾ ਸਕੂਲ ਹੈ ਪੁਰਾਣੇ ਛਾਲੇ ਦੇ ਵਿੱਚ ਆਈ ਸੀ ਐੱਸ ਈ ਆਈਸੀਐੱਸਈ ਬੋਰਡ ਹੈ ਫੈਸਿਲਿਟੀਜ ਸਟਾਫ ਜਿਹੜਾ ਹੈ ਵੈਲ ਕੁਆਲੀਫਾਈਡ ਹੈ ਐਕਸਪਰਟ ਟੀਚਰ ਉਹਨਾਂ ਨੇ ਲਗਾਏ ਵੇ ਹੈ ਅਤੇ ਜਿਹੜਾ ਸਟੱਡੀ ਮਟੀਰੀਅਲ ਵਗੈਰਾ ਜੋ ਵੀ ਬੱਚਿਆਂ ਨੂੰ ਹੈਗਾ ਵਾ ਉਹ ਵਧੀਆ ਤਰੀਕੇ ਦੇ ਨਾਲ ਪੜ੍ਹਾਉਂਦੇ ਹੈ ਟੀ ਐੱਲ ਐੱਮ ਯੂਜ ਕਰਦੇ ਹੈ ਹੈ ਨਾ ਅਤੇ ਪ੍ਰੋਜੈਕਟਰ ਦੇ ਥਰੂ ਪੜ੍ਹਾਉਂਦੇ ਬੱਚਿਆਂ ਨੂੰ ਬੱਚੇ ਦੱਸਦੇ ਆ ਕਿ ਕੀ ਜਿਵੇਂ ਮਤਲਬ ਕਿ ਟੋਕਿੰਗ ਵਗੈਰਾ ਉਹ ਵੀ ਇੰਗਲਿਸ਼ ਦੇ ਵਿੱਚ ਹੀ ਕਰਵਾਉਂਦੇ ਹੈ ਬਹੁਤਾ ਸਟਾਫ ਅੱਛਾ ਕੋਪਰੇਟਿਵ ਹੈ ਹਾਂ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਅਤੇ ਵਧੀਆ ਸਭ ਠੀਕ ਠਾਕ ਅਤੇ ਤੁਸੀਂ ਕੋਈ ਗੱਲ ਨਹੀਂ ਪਾਉਣੇ ਬੱਚੇ ਆਪਣੇ ਅਤੇ ਤੁਸੀਂ ਪਾਓ ਇੱਥੇ ਵਧੀਆ ਸਕੂਲ ਹੈਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਜ਼ਰੂਰ ਕੋਈ ਨਹੀਂ ਦੱਸਿਓ ਤੁਸੀਂ ਮੈਂ ਜ਼ਰੂਰ ਚੱਲਾਂਗੀ ਨਾਲ ਤੁਹਾਡੇ ਵਾਧੂ ਹੈਗਾ ਸਟਾਫ